ਹਾਈਕ ਕਰਨ ਦੇ ਲਈ ਮੇਰੀ ਸਭ ਤੋਂ ਮਨ ਪਸੰਦ ਇਲਾਕਾ ਪਹਾੜੀ ਇਲਾਕਾ ਮੈਨੂੰ ਪਹਾੜਾਂ 'ਤੇ ਬਰਫੀਲੇ ਪਹਾੜ ਦੇਖਣੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਉੱਚਾਈ 'ਤੇ ਖੜ੍ਹ ਕੇ ਸਾਰਾ ਦ੍ਰਿਸ਼ ਬਹੁਤ ਹੀ ਸੋਹਣਾ ਲੱਗਦਾ ਆ ਪਿਛਲੇ ਸਾਲ ਮੈਂ ਆਪਣੇ ਦੋਸਤਾਂ ਦੇ ਨਾਲ ਕਸ਼ਮੀਰ ਗਈ ਸੀ ਉੱਥੇ ਜਾ ਕੇ ਅਸੀਂ ਬਹੁਤ ਜ਼ਿਆਦਾ ਮਜ਼ਾ ਕੀਤਾ ਉੱਥੇ ਅਸੀਂ ਬੋਟਿੰਗ ਵੀ ਕੀਤੀ ਪਹਾੜਾਂ 'ਤੇ ਬਰਫੀਲੇ ਪਹਾੜਾਂ 'ਤੇ ਅਸੀਂ ਸਨੋਅ ਦੇ ਨਾਲ ਬਰਫ਼ ਦੇ ਨਾਲ ਬਹੁਤ ਜ਼ਿਆਦਾ ਖੇਡੇ ਅਸੀਂ ਬਹੁਤ ਜ਼ਿਆਦਾ ਮਜ਼ਾ ਕੀਤਾ ਜੋ ਇਹ ਪਹਾੜਾਂ ਦਾ ਦ੍ਰਿਸ਼ ਸੀਗਾ ਉੱਚੇ ਉੱਚੇ ਪਹਾੜ ਬਹੁਤ ਜ਼ਿਆਦਾ ਵਧੀਆ ਸੀਗਾ ਅਸੀਂ ਸ਼ਾਮ ਨੂੰ ਬਹੁਤ ਜ਼ਿਆਦਾ ਮਤਲਬ ਫਨ ਕੀਤਾ ਅਸੀਂ ਬੋਟ ਦੇ ਵਿੱਚ ਹੀ ਰਹੇ ਸੀਗੇ ਬੋਟ ਹੀ ਸਾਡਾ ਮਤਲਬ ਦੋ ਦਿਨਾਂ ਦੇ ਲਈ ਘਰ ਸੀ ਜਿੱਥੇ ਸਾਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਅਤੇ ਇੱਕ ਵਾਰ ਮੈਂ ਆਪਣੇ ਕ ਪੇਰੈਂਟਸ ਦੇ ਨਾਲ ਬੀਚ 'ਤੇ ਵੀ ਗਈ ਸੀ ਮੇਰਾ ਬੀਚ ਦਾ ਵੀ ਐਕਸਪੀਰੀਅਸ ਸੀਗਾ ਜੋ ਬਹੁਤ ਜ਼ਿਆਦਾ ਵਧੀਆ ਰਿਹਾ